ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਹੁੰਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਸਟ੍ਰੀਮਿੰਗ ਸੇਵਾ ਵੀ ਡਿਜੀਟਲ ਹੋ ਗਈ ਹੈ ਡਿਜੀਟਲ ਸਟ੍ਰੀਮਿੰਗ ਸੇਵਾ ਦੇ ਕਾਰਨ ਅਸੀਂ ਕਿਸੇ ਵੀ ਪਿਕਚਰ ਨੂੰ ਜਿੱਥੇ ਮਰਜ਼ੀ ਅਤੇ ਕਿਸੇ ਵੀ ਸਮੇਂ ਦੇਖ ਸਕਦੇ ਹਨ ਸਾਨੂੰ ਬਿਨਾਂ ਹੀ ਕਿਸੇ ਬਰੇਕ ਤੋਂ ਅਸੀਂ ਕੋਈ ਵੀ ਪਿਕਚਰ ਆਦਿ ਚੀਜ਼ਾਂ ਦੇਖ ਸਕਦੇ ਹਨ ਡਿਜੀਟਲ ਸਟ੍ਰੀਮਿੰਗ 'ਤੇ ਸਕੈਮ ਨਾਈਟੀ ਨਾਈਟੀ ਟੂ ਮਨੀ ਹਿਸਟ ਯੋਗੀ ਆਦਿ ਪਿਕਚਰਾਂ ਐਵੀਲੇਬਲ ਹਨ ਲਗਭਗ ਕੋਈ ਵੀ ਪਿਕਚਰ ਹੋਵੇ ਉਹ ਸਾਨੂੰ ਡਿਜੀਟਲ ਸਟ੍ਰੀਮਿੰਗ ਮੀਡੀਆ 'ਤੇ ਉਪਲਬਧ ਹੋ ਹੀ ਜਾਂਦੀਆਂ ਹਨ ਕੁਛ ਦੇਰ ਪਹਿਲਾਂ ਹੀ ਮੈਂ ਯੋਗੀ ਪਿਕਚਰ ਦੇਖ ਕੇ ਹਟੇ ਜਿਸ ਵਿੱਚ ਦਲਜੀਤ ਦੋਸਾਂਝ ਨੇ ਮੇਨ ਲੀਡ ਦਾ ਰੋਲ ਕੀਤਾ ਸੀ ਇਸ ਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਉੱਨੀ ਸੌ ਚੁਰਾਸੀ ਦੇ ਦੰਗੇ ਹੋਏ ਅਤੇ ਕਿਵੇਂ ਕਿਵੇਂ ਦੀਆਂ ਘਟਨਾਵਾਂ ਵਾਪਰੀਆਂ ਅਤੇ ਉਹਨਾਂ ਦਾ ਸਮਾਜ ਉੱਤੇ ਕੀ ਅਸਰ ਹੋਇਆ